ਸਾਡੇ ਇਲਾਕੇ ਵਿੱਚ ਮੇਰੀ ਫਰੈਂਡ ਆ ਜਿਹਦਾ ਨਾਮ ਜਪਨੀਤ ਹੈ ਉਹ ਬਹੁਤ ਸੋਹਣੀ ਪੇਂਟਿੰਗ ਕਰਦੀ ਆ ਅਤੇ ਜਦੋਂ ਉਹ ਪੇਂਟਿੰਗ ਕਰਦੀ ਹੈ ਤਾਂ ਪੂਰੀ ਆਪਣੀ ਕੰਨਸਟਰੇਸ਼ਨ ਨਾਲ ਮੀਨਸ ਉਹ ਜਿਹੜੀ ਚੀਜ਼ ਭਾਵੇਂ ਉਹਦੇ ਕੋਈ ਚੀਜ਼ ਮੋਹਰੇ ਰੱਖ ਦਿਉ ਉਹ ਇਹੋ ਜਿਹੀ ਚੀਜ਼ ਬਣਾਉਂਦੀ ਆ ਕਿ ਕੋਈ ਬੰਦਾ ਕਹਿ ਨਹੀਂ ਸਕਦਾ ਹੈਗਾ ਕਿ ਇਹ ਅਸਲੀ ਚੀਜ਼ ਨਹੀਂ ਹੈਗੀ ਭਾਵੇਂ ਉਹ ਇੱਕ ਕੋਰੇ ਕਾਗਜ਼ 'ਤੇ ਹੀ ਕਿਉਂ ਨਾ ਹੋਵੇ ਜੇ ਕੋਰੇ ਕਾਗਜ਼ 'ਤੇ ਹੁੰਦੇ ਹੋਣ ਦੇ ਬਾਵਜੂਦ ਵੀ ਉਹ ਇੰਨੀ ਜ਼ਿਆਦਾ ਕੁਦਰਤੀ ਲੱਗਦੀ ਹੈ ਕਿ ਉਸਨੂੰ ਕੋਈ ਦੇਖ ਕੇ ਕਹਿ ਨਹੀਂ ਸਕਦਾ ਕਿ ਇਹ ਡਰੋਅ ਕੀਤੀ ਹੋਈ ਚੀਜ਼ ਹੈ ਅਤੇ ਇਹਦੀਆਂ ਜਿਹੜੀਆਂ ਕਿ ਪੇਂਟਿੰਗਸ ਆ ਉਹ ਬਹੁਤ ਦੂਰ ਦੂਰ ਤੱਕ ਫੈਲੀਆਂ ਹੋਈਆਂ ਨੇ ਬਹੁਤ ਸਾਰੇ ਇਹਨੂੰ ਬਣਾਉਣ ਦੇ ਲਈ ਔਡਰ ਵੀ ਦਿੰਦੇ ਨੇ ਵੀ ਸਾਡੀ ਵੀ ਇਹੋ ਜਿਹੀ ਕੁਛ ਪੇਂਟਿੰਗ ਵਗੈਰਾ ਬਣਾਈ ਜਾਵੇ